ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੇ ਜੂਨ ਉੱਨੀ ਸੌ ਚੁਰਾਸੀ ਤੇਈ ਮਾਰਚ ਉੱਨੀ ਸੌ ਬੱਤੀ ਨੌਂ ਨਵੰਬਰ ਦੋ ਹਜ਼ਾਰ ਪੰਜ ਛੱਬੀ ਜਨਵਰੀ ਉੱਨੀ ਸੌ ਪੰਜਾਹ